ਹੈਲੋ ਹਾਂਜੀ ਹਾਂਜੀ ਹਾਂਜੀ ਆਪ ਕੌਣ ਜੀ ਹਾਂਜੀ ਠੀਕ ਹੈ ਜੀ

ਹਾਂਜੀ ਹਾਂਜੀ ਬਿਲਕੁਲ ਸਰ ਕੰਮ ਹੀ ਫਰਨੀਚਰ ਦਾ ਜੀ ਆਪਣਾ ਠੀਕ ਹੈ ਜੀ ਨਹੀਂ ਸਰ ਨਹੀਂ ਬਿਲਕੁਲ ਸਾਡੀ ਆਪਣੀ ਫੈਕਟਰੀ ਆ ਜੀ ਉਹਦੇ ਵਿੱਚ ਅਸੀਂ ਆਪਣੇ ਕਾਰੀਗਰ ਰੱਖੇ ਹੋਏ ਨੇ ਸਾਡਾ ਆਪਣਾ ਬ੍ਰੈਂਡ ਹੈ ਅਸੀਂ ਆਪ ਤਿਆਰ ਕਰਦੇ ਆ ਜੀ

ਹਾਂਜੀ ਹਾਂਜੀ ਨਹੀਂ ਕੁਆਲਿਟੀ ਦੀ ਗਰੰਟੀ ਆ ਆਪਣੀ ਹਾਂਜੀ ਗਿਆਰਾਂ ਸੈੱਟ ਦਾ ਸਰ ਤੁਹਾਨੂੰ ਮਿਲ ਜੇਗਾ ਜੀ ਤਕਰੀਬਨ ਪੰਤਾਲੀ ਹਜ਼ਾਰ ਰੁਪਏ ਦਾ ਜੀ ਜਿਹੜਾ ਮਾਰਕੀਟ ਦੇ ਵਿੱਚ ਬਾਹਰ ਸੱਤਰ ਹਜ਼ਾਰ ਰੁਪਏ ਦਾ ਹੈ ਅਸੀਂ ਤੁਹਾਨੂੰ ਉਹ ਪੰਤਾਲੀ ਹਜ਼ਾਰ ਦੇ ਵਿੱਚ ਤਿਆਰ ਕਰਕੇ ਦੇਵਾਂਗੇ ਜੀ ਗਰੰਟੀ ਜੀ ਦਸ ਸਾਲ ਦੀ ਗਰੰਟੀ ਹੈ ਜੀ ਇਸ ਦੀ ਪੋਲਿਸ਼ ਦੀ ਵੀ ਗਰੰਟੀ ਹੈ ਜੀ ਸਪਰਿੰਗਾਂ ਦੀ ਵੀ ਗਰੰਟੀ ਹੈ ਅਤੇ ਉਪਰਲਾ ਫੋਮ ਹੈ ਜੀ ਉਹ ਵੀ ਚੰਗੀ ਕਿਸਮ ਦਾ ਲੱਗਿਆ ਉਹਦੀ ਵੀ ਗਰੰਟੀ ਹੈ ਜੀ ਪੂਰੀ ਗਰੰਟੀ ਦੇਵਾਂਗੇ ਜੀ ਤੁਹਾਨੂੰ ਗਰੰਟੀ ਸਰ ਇਹਦੀ ਸਪਰਿੰਗ ਦੀ ਦਸ ਸਾਲ ਦੀ ਹੈ ਜੀ ਜਿਹੜੀ ਉੱਪਰ ਫੋਮ ਐ ਜੀ ਉਹਦੀ ਦੋ ਸਾਲ ਦੀ ਆ ਬਸ ਬੱਚੇ ਨੂੰ ਬਲੇਡ ਵਗੈਰਾ ਤੋਂ ਦੂਰ ਰੱਖਿਓ ਵੀ ਬਲੇਡ ਵਗੈਰਾ ਕਈ ਯੂਸ ਹੋਏ ਕਰਦੇ ਨਾ ਕਿਉਂਕਿ ਫੇਰ ਤਾਂ ਸਰ ਗਰੰਟੀ ਉਹਦੀ ਕੀ ਕਰੇਗੀ ਹਾਂਜੀ ਹਾਂਜੀ ਹਾਂਜੀ ਡਾਈਨਿੰਗ ਟੇ ਡਾਈਨਿੰਗ ਟੇਬਲ ਸਰ ਆਪਣੇ ਕੋਲ ਦੋ ਤਰ੍ਹਾਂ ਦੇ ਨੇ ਜੀ ਇੱਕ ਪੱਥਰ ਵਾਲਾ ਚੱਲਦਾ ਜਿਹੜਾ ਅੱਜ ਕੱਲ੍ਹ ਜੀ ਇੱਕ ਸ਼ੀਸ਼ੇ ਵਾਲਾ ਪਹਿਲਾਂ ਚਲਦਾ ਸੀ ਜਿਹੜਾ ਸ਼ੀਸ਼ੇ ਵਾਲਾ ਹੈ ਜੀ ਉਹ ਤੁਹਾਨੂੰ ਤਕਰੀਬਨ ਤੇਈ ਕੁ ਹਜ਼ਾਰ ਦਾ ਦੇਵਾਂਗੇ ਜੀ ਥਰਟੀ ਥਾਊਸੰਡ ਅਤੇ ਜੋ ਪਤ ਅੱਜ ਕੱਲ੍ਹ ਟਰੈਂਡ ਪੱਥਰ ਵਾਲਾ ਚੱਲ ਰਿਹਾ ਜੀ ਉਹ ਥੋੜ੍ਹਾ ਜਿਹਾ ਕੋਸਟਲੀ ਹੈ ਉਹ ਪੰਤਾਲੀ ਕੁ ਹਜ਼ਾਰ ਰੁਪਏ ਦਾ ਪਵੇਗਾ ਜੀ ਤੁਹਾਨੂੰ ਛੇ ਕੁਰਸੀਆਂ ਦਾ ਇਹ ਸਰ ਸਾਗਵਾਨ ਲੱਕੜ ਹੈ ਜੀ ਆਪਣੇ ਕੋਲ ਸਾਰੀ ਟਾਲੀ ਵੀ ਸਰ ਮਿਲ ਜੇਗਾ ਤੁਹਾਡੀ ਰਿਕਐਰਮੈਂਟ ਦੇ ਅਕੋਰਡਿੰਗ ਜਿਵੇਂ ਕਹੋਂਗੇ ਉਵੇਂ ਹੀ ਤਿਆਰ ਕਰਕੇ ਦੇਵਾਂਗੇ ਜੀ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਜਿਹੜਾ ਪ੍ਰਾਈਸ ਹੈ ਦੇਣਾ ਪਵੇਗਾ ਵੈਸੇ ਸਾਗਵਾਨ ਲੋਕ ਜ਼ਿਆਦਾ ਪ੍ਰੈਫਰ ਕਰਦੇ ਹੈ ਜੀ ਅਸੀਂ ਵੀ ਹਾਂਜੀ ਹਾਂਜੀ ਇੱਕ ਵਾਰੀ ਦਿਓ ਤੁਸੀਂ ਦਰਸ਼ਨ ਹਾਂਜੀ ਹਾਂਜੀ ਹਾਂਜੀ ਨੌਂ ਵਜੇ ਤੋਂ ਲੈ ਕੇ ਸ਼ਾਮ ਨੂੰ ਅੱਠ ਵਜੇ ਤੱਕ ਜੀ ਤੁਸੀਂ ਕਿਸੇ ਵੀ ਟਾਈਮ ਦਰਸ਼ਨ ਦੇ ਸਕਦੇ ਹੋ ਠੀਕ ਹੈ ਸਰ ਧੰਨਵਾਦ ਸਰ ਜ਼ਰੂਰ ਓਕੇ ਜੀ